ਦੋ ਮਾਰਚ ਉੱਨੀ ਪਚਾਸੀ ਦਸ ਅਪ੍ਰੈਲ ਉੱਨੀ ਨੜਿਨਵੇਂ ਪੱਚੀ ਮਈ ਵੀਹ ਦਸ ਉੱਨੀ ਜਨਵਰੀ ਵੀਹ ਪੰਦਰਾਂ ਤੀਹ ਫਰਵਰੀ ਵੀਹ ਇੱਕੀ